ਜਿੱਦਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਅੱਜ ਕੱਲ੍ਹ ਬਹੁਤ ਤਰ੍ਹਾਂ ਦੇ ਸੂਟ ਚੱਲ ਪਏ ਹਨ ਜਿੱਦਾਂ ਕਿ ਪਲਾਜੋ ਸੂਟ ਪੈਂਟ ਸੂਟ ਹੋਰ ਵੀ ਕਾਫ਼ੀ ਤਰ੍ਹਾਂ ਦੇ ਸ਼ਰਾਰਾ ਸੂਟ ਚੱਲ ਪਏ ਹਨ ਜਿਹਨਾਂ ਨੂੰ ਸੀਣਾ ਬਹੁਤ ਹੀ ਔਖਾ ਹੈ ਜਿੱਦਾਂ ਕਿ ਪਹਿਲਾਂ ਸਿੰਪਲ ਸਲਵਾਰ ਸੂਟ ਹੀ ਚੱਲਦੇ ਸਨ ਬਸ ਇਸ ਕਰਕੇ ਇਹ ਸੂਟਾਂ ਨੂੰ ਸੀਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਸਾਡੇ ਲਈ ਸਭ ਤੋਂ ਔਖਾ ਹੁੰਦਾ ਹੈ ਸ਼ਰਾਰਾ ਸੂਟ ਅਤੇ ਪੈਂਟ ਸੂਟ ਜਿਨ੍ਹਾਂ ਨੂੰ ਸੀਣ ਲਈ ਬਹੁਤ ਹੀ ਟਾਈਮ ਲੱਗਦਾ ਹੈ ਕਦੇ ਕਦੇ ਤਾਂ ਪੂਰਾ ਦਿਨ ਹੀ ਨਿਕਲ ਜਾਂਦਾ ਹੈ ਇਹਨਾਂ ਨੂੰ ਸੀਣ ਲਈ ਪੂਰਾ ਦਿਨ ਹੀ ਨਿਕਲ ਜਾਂਦਾ ਹੈ ਜਿੱਥੇ ਅਸੀਂ ਦੇਖੀਏ ਦੂਜੇ ਦੂਜੇ ਪਾਸੇ ਸਲਵਾਰ ਸੂਟ ਬਹੁਤ ਹੀ ਸੌਖੇ ਤਰੀਕੇ ਨਾਲ ਸੀਤਾ ਜਾਂਦਾ ਹੈ ਇਸ ਲਈ ਸਾਨੂੰ ਕਦੇ ਕਦੇ ਇੰਟਰਨੈਟ ਦੀ ਮਦਦ ਵੀ ਲੈਣੀ ਪੈ ਜਾਂਦੀ ਹੈ ਜਿੱਦਾਂ ਕਿ ਯੂਟਿਊਬ ਯੂਟਿਊਬ 'ਤੇ ਬੜੇ ਹੀ ਸੌਖੀਆਂ ਤਕਨੀਕਾਂ ਨਾਲ ਉਹ ਸਿਖਾਉਂਦੇ ਹਨ ਕਿ ਕਿੱਦਾਂ ਕਿਸ ਤਰ੍ਹਾਂ ਅਸੀਂ ਸਲਵਾ ਪਲਾਜੋ ਸੂਟਾਂ ਨੂੰ ਜਾਂ ਪੈਂਟ ਸੂਟਾਂ ਨੂੰ ਸੀ ਸਕੀਏ ਜਿਸ ਨਾਲ ਸਾਡਾ ਟਾਈਮ ਵੀ ਬਚਦਾ ਹੈ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੂਟ ਸੀ ਸਕਦੇ ਹਾਂ ਇਸ ਤਰ੍ਹਾਂ ਇੰਟਰਨੈਟ ਬਹੁਤ ਹੀ ਫਾਇਦੇਮੰਦ ਹੈ ਅਤੇ ਇਹ ਚੀਜ਼ਾਂ ਵਿੱਚ ਬਹੁਤ ਹੀ ਵਾਧਾ ਕਰਾਉਂਦਾ ਹੈ ਜਿਸ ਨਾਲ ਜਿੰਨੇ ਜ਼ਿਆਦਾ ਸੂਟ ਸੀਈਏ ਉਹਦੇ ਨਾਲ ਸਾਨੂੰ ਸਾਡੀ ਕਮਾਈ ਵਿੱਚ ਵੀ ਵਾਧਾ ਹੁੰਦਾ ਹੈ ਇਸ ਲਈ ਸਾਨੂੰ ਚਾਹੀਦਾ ਸਾਨੂੰ ਹਰ ਕਿਸੇ ਨੂੰ ਚਾਹੀਦਾ ਹੈ ਕਿ ਜੇ ਕੋਈ ਚੀਜ਼ ਨਾ ਆਉਂਦੀ ਹੋਵੇ ਤਾਂ ਸਾਨੂੰ ਯੂਟੀਊਬ ਰਾਹੀਂ ਉਹ ਚੀਜ਼ ਸਿੱਖਣੀ ਚਾਹੀਦੀ ਹੈ ਅਤੇ ਆਪਣੇ ਕੰਮਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ ਜਿਹੜੀ ਬਹੁਤ ਹੀ ਫਾਇਦੇਮੰਦ ਚੀਜ਼ ਹੁੰਦੀ ਹੈ ਧੰਨਵਾਦ